ਬਾਈ ਸਤੰਬਰ ਉੱਨੀ ਸੌ ਪੰਝੱਤਰ ਵੀਹ ਦਸੰਬਰ ਉੱਨੀ ਸੌ ਅਠੱਤਰ ਪੰਜ ਨਵੰਬਰ ਉੱਨੀ ਸੌ ਅਠਾਸੀ ਅੱਠ ਨਵੰਬਰ ਉੱਨੀ ਸੌ ਸਤਾਸੀ ਚੌਦ੍ਹਾਂ ਨਵੰਬਰ ਉੱਨੀ ਸੌ ਪੰਜਾਹ